ਮੈਨੂੰ ਗੋਡਿਆਂ ਵਿੱਚ ਬੜੀ ਦਿੱਕਤ ਆ ਰਹੀ ਹੈ ਮੈਂ ਫਿਜੀਓਥਰੈਪੀ ਲੈਣਾ ਚਾਹੁੰਦੀ ਹਾਂ ਔਰ ਇਹ ਸਾਡੇ ਸਿਹਤ ਦੇ ਬੀਮੇ ਦੇ ਅਧੀਨ ਆਉਂਦੇ ਹਨ ਮੈਂ ਬੀਮਾ ਕੰਪਨੀ ਵਾਲਿਆਂ ਨੂੰ ਫੋਨ ਕਰਕੇ ਪੁੱਛਿਆ ਕਿ ਇਹ ਸਾਡੇ ਕਵਰੇਜ ਦੇ ਵਿੱਚ ਆਉਣਗੇ ਜਾਂ ਨਹੀਂ ਪਰ ਉਨ੍ਹਾਂ ਨੇ ਮਨ੍ਹਾਂ ਕਰ ਦਿੱਤਾ ਕਿਹਾ ਕਿ ਇਹ ਤੁਹਾਡੇ ਉਹਦੇ ਵਿੱਚ ਕਵਰ ਨਹੀਂ ਹੋਣਗੇ